ਜੀ ਹਾਂ ਜਦੋਂ ਮੈਂ ਪੜ੍ਹਨ ਲਈ ਚੰਡੀਗੜ੍ਹ ਰਹਿੰਦਾ ਸੀ ਉਸ ਵਕਤ ਮੇਰਾ ਇੱਕ ਦੋਸਤ ਜੋ ਕਿ ਗਾਣਿਆਂ ਵਿੱਚ ਕੰਮ ਕਰਦਾ ਹੈ ਉਸਦੇ ਗਾਣਿਆਂ ਦੀ ਸ਼ੂਟਿੰਗ ਹੋ ਰਹੀ ਸੀ ਮੈਂ ਵੀ ਉਸ ਦੇ ਨਾਲ ਸੈੱਟ 'ਤੇ ਗਿਆ ਸੀ ਸ਼ੂਟਿੰਗ ਵਧੀਆ ਡਿਜੀਟਲ ਕੈਮਰਿਆਂ ਦੇ ਨਾਲ ਹੋ ਰਹੀ ਸੀ ਜੋ ਕਿ ਫੋਟੋਗ੍ਰਾਫਰੀ ਤੋਂ ਥੋੜ੍ਹੇ ਜ਼ਿਆਦਾ ਆਧੁਨਿਕ ਹੁੰਦੇ ਹਨ ਉਨ੍ਹਾਂ ਦੇ ਕਲੈਰਟੀ ਵੀ ਵਧੀਆ ਹੁੰਦੀ ਹੈ ਮੈਂ ਵੀ ਡਿਜੀਟਲ ਕੈਮਰਿਆਂ ਵਿੱਚ ਆਪਣੀ ਫੋਟੋ ਖਿਚਵਾਈ ਅਤੇ ਵੀਡੀਓ ਬਣਵਾਈ ਜੋ ਕਿ ਕਾਫ਼ੀ ਵਧੀਆ ਬਣੀ ਸੀ ਇਹ ਇੱਕ ਮੇਰਾ ਅਨੁਭਵ ਸੀ ਜਿਸ ਨੇ ਮੇਰੇ ਫੋਟੋਗ੍ਰਾਫਰੀ ਦੇ ਸ਼ੌਂਕ ਨੂੰ ਵਧਾਵਾ ਦਿੱਤਾ ਅਤੇ ਫ਼ਿਲਮ ਦੀ ਸ਼ੂਟਿੰਗ ਫੋਟੋਗ੍ਰਾਫਰੀ ਤੋਂ ਬਹੁਤ ਅਲੱਗ ਹੁੰਦੀ ਹੈ ਜਿਸ ਵਿੱਚ ਕਾਫ਼ੀ ਤਰੁੱਟੀਆਂ ਹੁੰਦੀਆਂ ਹਨ ਅਤੇ ਬੈਗਰਾਉਂਡ ਨੂੰ ਆਪਣੇ ਹਿਸਾਬ ਦੇ ਨਾਲ ਬਣਾਇਆ ਜਾਂਦਾ ਹੈ ਜਦੋਂ ਕਿ ਫੋਟੋਗ੍ਰਾਫਰੀ ਲਈ ਕਿਸੇ ਖ਼ਾਸ ਬੈਗਰਾਉਂਡ ਦੀ ਲੋੜ ਨਹੀਂ ਪੈਂਦੀ